ਜੇਕਰ ਆਪਾਂ ਰੰਗੋਲੀ ਦੀ ਗੱਲ ਕਰੀਏ ਤਾਂ ਰੰਗੋਲੀ ਹਰ ਇੱਕ ਤਿਉਹਾਰ ਤਿਉਹਾਰ ਨੂੰ ਮਨਾਉਣ ਦੇ ਲਈ ਬਣਾਈ ਜਾਂਦੀ ਹੈ ਰੰਗੋਲੀ ਦੇ ਵਿੱਚ ਜਿੱਦਾਂ ਘਰਾਂ ਦੇ ਮੇਨ ਗੇਟਾਂ ਵਿੱਚ ਵੈੱਲਕਮ ਲਿਖਿਆ ਜਾਂਦਾ ਹੈ ਜਾਂ ਅਸੀਂ ਕਿਸੇ ਨਵੇਂ ਪਰਿਵਾਰਕ ਮੈਂਬਰ ਨੂੰ ਘਰ ਵਿੱਚ ਲਿਆਉਂਦੇ ਹਾਂ ਜਦੋਂ ਉਸ ਉਹ ਬੱਚਾ ਜਾਂ ਕੋਈ ਵੀ ਘਰ ਵਿੱਚ ਆਉਂਦਾ ਹੈ ਜਾਂ ਕੋਈ ਨਵਾਂ ਪ੍ਰਾਹੁਣਾ ਆਉਂਦਾ ਹੈ ਪਹਿਲੀ ਵਾਰ ਆਉਂਦਾ ਹੈ ਤਾਂ ਘਰ ਵਿੱਚ ਰੰਗੋਲੀ ਬਣਾ ਕੇ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਉਸ ਨੂੰ ਵੈੱਲਕਮ ਬੋਲਿਆ ਜਾਂਦਾ ਹੈ ਸੂਰਜ ਨੂੰ ਪਾਣੀ ਚੜ੍ਹਾਉਣਾ ਸੂਰਜ ਨੂੰ ਪਾਣੀ ਚੜ੍ਹਾਉਣਾ ਇਹ ਪੰਡਤਾਂ ਦੀ ਪਰੰਪਰਾ ਹੈ ਉਹ ਸੂਰਜ ਨੂੰ ਪਾਣੀ ਚੜ੍ਹਾਉਂਦੇ ਹਨ ਪਾਣੀ ਚੜ੍ਹਾਉਣ ਦੇ ਨਾਲ ਕਿਸੇ ਉਸਦਾ ਸ ਉਨ੍ਹਾਂ ਦਾ ਦਿਮਾਗ ਫਰੈੱਸ਼ ਰਹਿੰਦਾ ਹੈ ਸਿਰ ਨਹੀਂ ਦੁਖਦਾ ਮੱਥੇ 'ਤੇ ਸੰਦੂਰ ਲਾਉਣਾ ਮੱਥੇ 'ਤੇ ਸੰਦੂਰ ਅੱਜ ਕੱਲ੍ਹ ਦੀ ਅੱਜ ਕੱਲ੍ਹ ਦੀ ਅਤੇ ਪੁਰਾਣੀ ਪਰੰਪਰਾ ਚੱਲਦੀ ਆ ਰਹੀ ਹੈ ਜਦੋਂ ਕੋਈ ਨਵੀਂ ਬੋਲੀ ਜਾਂ ਕੋਈ ਫੰਕਸ਼ਨ 'ਚ ਜਾਣਾ ਜਾਂ ਘਰ ਵਿੱਚ ਰਹਿਣਾ ਹਰ ਇੱਕ ਔਰਤ ਆਪਣੇ ਆਪਣੇ ਘਰਵਾਲੇ ਦੀ ਖੁਸ਼ੀ ਦੇ ਲਈ ਆਪਣੇ ਸੁਹਾਗ ਦੇ ਲਈ ਮੱਥੇ 'ਤੇ ਸੰਦੂਰ ਲਵਾਉਂ ਲਾਉਂਦੀ ਹੈ ਪਵਿੱਤਰ ਧਾਗਾ ਪਾਉਣਾ ਇਹ ਪਵਿੱਤਰ ਧਾਗਾ ਪਾਉਣਾ ਇਹ ਮੁਸਲਮਾਨਾਂ ਦੀ ਨਿਸ਼ਾਨੀ ਹੁੰਦੀ ਹੈ ਪਵਿੱਤਰ ਧਾਗਾ ਮੁਸਲਮਾਨ ਹੀ ਬੰਨ੍ਹਦੇ ਹਨ ਪੂਜਾ ਲਈ ਮੰਦਰ ਜਾਣਾ ਮੰਦਰ ਜਾ ਮੰਦਰ ਪੰਡਤ ਜਾਂਦੇ ਹਨ ਪੰਡਤ ਮੰਦਰ ਜਾ ਕੇ ਆਪਣੇ ਦੇਵੀ ਦੇਵਤਿਆਂ ਨੂੰ ਜਲ ਚੜ੍ਹਾਉਂਦੇ ਹਨ ਦਰਗਾਹ 'ਤੇ ਜਾਣਾ ਦਰਗਾਹ ਮੁਸਲਮਾਨਾਂ ਦੀ ਪਵਿੱਤਰ ਜਗ੍ਹਾ ਹੈ ਅਤੇ ਉਹ ਰੋਜੇ ਰੱਖਦੇ ਹਨ ਰੋਜੇ ਰੱਖ ਕੇ ਉਹ ਇੱਕ ਸ ਐਪਲ ਦੀ ਹੀ ਸੇਬ ਦੀ ਹੀ ਵਰਤੋਂ ਕਰਦੇ ਹਨ ਇਸ ਤੋਂ ਬਿਨਾਂ ਹੋਰ ਕੋਈ ਖਾਣਾ ਨਹੀਂ ਖਾਂਦੇ ਹਨ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਧਾਰਮਿਕ ਰੀਤਾਂ ਦਾ ਵੀ ਸਾਡੇ ਸੱਭਿਆਚਾਰ ਵਿੱਚ ਮਹੱਤਵ ਹੈ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਇਹ ਇੱਕ ਸਿੱਖ ਦੀਆਂ ਹੀ ਨਿਸ਼ਾਨੀਆਂ ਹਨ ਰੰਗੋਲੀ ਸੂਰਜ ਨੂੰ ਪਾਣੀ ਚੜ੍ਹਾਉਣਾ ਸਭ ਸਾਡੇ ਸੱਭਿਆਚਾਰਕ ਦੀਆਂ ਹੀ ਨਿਸ਼ਾਨੀਆਂ ਹਨ